ਵੀਹ ਦਸੰਬਰ ਉੱਨੀ ਸੌ ਬਾਨ੍ਹਵੇਂ ਚੌਵੀ ਦਸੰਬਰ ਉੱਨੀ ਸੌ ਚੁਰਾਨਵੇਂ ਤੇਰ੍ਹਾਂ ਅਕਤੂਬਰ ਦੋ ਹਜ਼ਾਰ ਇੱਕ ਦਸ ਮਈ ਦੋ ਹਜ਼ਾਰ ਪੰਜ ਇੱਕ ਜਨਵਰੀ ਦੋ ਹਜ਼ਾਰ ਨੌਂ